ਵੱਖਰੇ ਵੱਖਰੇ ਧਾਰਮਿਕ ਤਿਉਹਾਰਾਂ ਦੇ ਵੱਖਰੀਆਂ ਵੱਖਰੀਆਂ ਖਾਣ ਪੀਣ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਪਹਿਲਾਂ ਆਪਣੇ ਕੋਲ ਆ ਗਿਆ ਦਿਵਾਲੀ ਦਿਵਾਲੀ 'ਤੇ ਲੋਕ ਜਿਹੜੇ ਨੇ ਉਹ ਜ਼ਿਆਦਾਤਰ ਮਠਿਆਈ ਖਾਂਦੇ ਨੇ ਫਿਰ ਉਸ ਤੋਂ ਬਾਅਦ ਨਵਰਾਤਰੇ ਨਵਰਾਤਰਿਆਂ 'ਤੇ ਲੋਕ ਜਿਵੇਂ ਕਿ ਜ਼ਿਆਦਾਤਰ ਨਵਰਾਤਰਿਆਂ 'ਤੇ ਕੜਾਹ ਅਤੇ ਪੰਗੂਰ ਨਾਲ ਪੂੜੀਆਂ ਬਣਾਈਆਂ ਜਾਂਦੀਆਂ ਨੇ ਅਤੇ ਲੋਕ ਵਰਤ ਦੀਆਂ ਚੀਜ਼ਾਂ ਹੀ ਖਾ ਸਕਦੇ ਨੇ ਬਸ ਜਿਵੇਂ ਕਿ ਫਲ ਫਰੂਟ ਹੋ ਗਿਆ ਅਤੇ ਉਸ ਤੋਂ ਬਾਅਦ ਸ਼ਿਵਰਾਤਰੀ ਸ਼ਿਵਰਾਤਰੀ ਦੇ ਤਿਉਹਾਰ 'ਤੇ ਲੋਕ ਭੰਗ ਵਾਲੀ ਸ਼ਰਦਾਈ ਬਣਾਉਂਦੇ ਨੇ ਅਤੇ ਉਹ ਕੜੀ ਬਣਾਉਂਦੇ ਨੇ ਖੀਰ ਬਣਾਉਂਦੇ ਨੇ ਇਹ ਇਹ ਆ ਗਈਆਂ ਅਤੇ ਲੋਹੜੀ 'ਤੇ ਉਹ ਲੋਹੜੀ 'ਤੇ ਲੋਕ ਜ਼ਿਆਦਾਤਰ ਬਣਾਉਂਦੇ ਨੇ ਖਿਚੜੀ ਬਣਾਉਂਦੇ ਨੇ ਅਤੇ ਮਿੱਠੇ ਚੌਲ ਬਣਾਉਂਦੇ ਨੇ ਅਤੇ ਰੋਹ ਵਾਲੀ ਖੀਰ ਬਣਾਉਂਦੇ ਨੇ ਰੋਹ ਵਾਲੀ ਖੀਰ ਦੀ ਲੋਹੜੀ 'ਤੇ ਬਹੁਤ ਵੱਡੀ ਮਹੱਤਤਾ ਹੈ ਅਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਤਿਉਹਾਰ ਹਨ ਜਿਹਨਾਂ 'ਤੇ ਲੋਕ ਵੱਖ ਵੱਖ ਖਾਸ ਖਾਣ ਪੀਣ ਦੀਆਂ ਚੀਜ਼ਾਂ ਬਣਾਉਂਦੇ ਹਨ